ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਮੈਮ ਗੁਰਲਾਬ ਸਰ ਬੋਲ ਰਿਹਾ ਜੀ ਮੈਂ ਮੈਮ ਤੁਸੀਂ ਕੌਣ ਜੀ ਜੀ ਮੈਮ ਹਾਂਜੀ ਬੋਲੋ ਜੀ ਹਾਂਜੀ ਹਾਂਜੀ ਹਾਂਜੀ ਮੈਮ ਹੋ ਗਏ ਦੋ ਮੰਥ ਹੋ ਗਏ ਸਹਿਜਵੀਰ ਨੂੰ ਹਾਂਜੀ ਮੈਮ ਪਰਫੋਰਮੈਂਸ ਹੁਣ ਤਾਂ ਬੱਚੇ ਦੀ ਵਧੀਆ ਜੀ ਪਰ ਜਦੋਂ ਸਟਾਰਟਿੰਗ ਦੇ ਵਿੱਚ ਸਾਡੇ ਕੋਲ ਆਇਆ ਸੀਗਾ ਉਦੋਂ ਥੋੜ੍ਹਾ ਜਿਹਾ ਸ਼ਰਮਾਉਂਦਾ ਸੀਗਾ ਪਰ ਉਹ ਜਿਵੇਂ ਜਿਵੇਂ ਮੈਂ ਉਹਨੂੰ ਹੁਣ ਤਿਆਰੀ ਕਰਵਾ ਰਿਹਾ ਭੰਗੜੇ ਦੀ ਤਾਂ ਸਾਡਾ ਬੇਸਿਕ ਹੁੰਦਾ ਪਹਿਲਾਂ ਝੂਮਰ ਵਗੈਰਾ ਤੋਂ ਸਟਾਰਟ ਕਰਵਾਉਣਾ ਹੁੰਦਾ ਜੀ ਅਸੀਂ ਝੂਮਰ ਤੋਂ ਸਟਾਰਟ ਕਰਵਾਇਆ ਉਹ ਹੁਣ ਡੇ ਦਰ ਡੇ ਵਧੀਆ ਉਹਦੇ ਵਿੱਚ ਇਮਪਰੂਵਮੈਂਟ ਆ ਰਹੀ ਹੈ ਜੀ ਬਾਕੀ ਮੇਰਾ ਹੁੰਦਾ ਜੀ ਮੈਂ ਇੱਕ ਹਫ਼ਤੇ ਦੇ ਵਿੱਚ ਬੱਚੇ ਨੂੰ ਕੋਈ ਦੋ ਤਿੰਨ ਫੋਰਮਸ ਕਰਵਾ ਦੇਣੇ ਹੁੰਦੇ ਹਾਂ ਕਲੀਅਰ ਜਿੱਦਾਂ ਝੂਮਰ ਹੋ ਗਿਆ ਜੀ ਧਮਾਲਾਂ ਹੋ ਗਈਆਂ ਅਤੇ ਫਿਰ ਉਹਦਾ ਪ੍ਰੋਸੈਸ ਅੱਗੇ ਅੱਗੇ ਚੱਲਦਾ ਰਹਿੰਦਾ ਇੱਕ ਹਫ਼ਤੇ ਦੇ ਵਿੱਚ ਤਾਂ ਮੈਂ ਝੂਮਰ ਅਤੇ ਧਮਾਲਾਂ ਦੀਆਂ ਕਰਵਾ ਕੇ ਅਤੇ ਫਿਰ ਜੇ ਚੈੱਕ ਕਰਦਾ ਰਹੀ ਵੀ ਬੱਚੇ 'ਚ ਕਿੰਨੀ ਕੁ ਇੰਪਰੂਵਮੈਂਟ ਆ ਰਹੀ ਆ ਮਤਲਬ ਕਿ ਮੈਮ ਠੀਕ ਆ ਬੱਚਾ ਹੁਣ ਕਾਫ਼ੀ ਇੰਪਰੂਵ ਹੋ ਗਿਆ ਜੀ ਮੈਮ ਹਾਂ ਸਟਾਰਟਿੰਗ 'ਚ ਤਾਂ ਸੀਗਾ ਬਟ ਹਾਂ ਹੁਣ ਥੋੜ੍ਹਾ ਜਿਹਾ ਗੱਲਬਾਤ ਕਰਨ ਲੱਗਾ ਬਾਕੀ ਬੱਚਿਆਂ ਨਾਲ ਵੀ ਖੁੱਲ੍ਹ ਕੇ ਹੱਸਦਾ ਖੇਡਦਾ ਅਤੇ ਮੈਨੂੰ ਵੀ ਬੁਲਾ ਲੈਂਦਾ ਖੁੱਲ੍ਹ ਕੇ ਕੋਈ ਗੱਲ ਹੋਵੇ ਤਾਂ ਮੈਨੂੰ ਵੀ ਦੱਸ ਦਿੰਦਾ ਹਾਂ ਪਹਿਲਾਂ ਪਹਿਲਾਂ ਉਹ ਨਾ ਤਾਂ ਕਿਸੇ ਬੱਚੇ ਨਾਲ ਚੰਗੀ ਤਰਾਂ ਗੱਲ ਕਰਦੇ ਅਤੇ ਮੇਰੇ ਤੋਂ ਵੀ ਸ਼ਾਇਦ ਡਰਦਾ ਹੀ ਸੀਗਾ ਜੀ ਹਾਂਜੀ ਹਾਂਜੀ ਮੈਮ ਜੀ ਜੀ ਮੈਮ ਇਹ ਤੁਸੀਂ ਬੇਫ਼ਿਕਰ ਰਹੋ ਮੈਮ ਕੋਈ ਗੱਲ ਨਹੀਂ ਹੁਣ ਡਾਂਸਿੰਗ ਮੇਰਾ ਕੰਮ ਹੀ ਡਾਂਸਿੰਗ ਦਾ ਜੀ ਅਤੇ ਇਹ ਬੱਚੇ ਨੂੰ ਕੋਈ ਗੱਲ ਨਹੀਂ ਮੈਂ ਹੁਣ ਪੂਰੀ ਪ੍ਰੋਪਰ ਤਰੀਕੇ ਨਾਲ ਤਿਆਰੀ ਕਰਵਾ ਰਿਹਾ ਅਤੇ ਹੋ ਸਕਦਾ ਮੈਮ ਮੈਂ ਨੈਕਸਟ ਮੰਥ ਤੱਕ ਨਾ ਵੀ ਇਹਨਾਂ ਦਾ ਇੱਕ ਕੰਪੀਟੀਸ਼ਨ 'ਤੇ ਲੈ ਕੇ ਜਾਵਾਂਗੇ ਈਵੈਂਟਸ ਆਉਂਦੇ ਰਹਿੰਦੇ ਆ ਕੰਪੀਟੀਸ਼ਨ ਦੇ ਵਿੱਚ ਵੀ ਮੈਂ ਇਹਨਾਂ ਦੇ ਇਹਦਾ ਪਾਰਟੀਸਪੇਟ ਕਰਵਾਊਂਗਾ ਉਸ ਲਈ ਮੈਂ ਇਹਦਾ ਕੋਈ ਨਵਾਂ ਸੈਟ ਤਿਆਰ ਕਰੂੰਗਾ ਜੀ ਜਿੱਦਾਂ ਯੂਥ ਫੈਸਟੀਵਲ 'ਤੇ ਵੀ ਬੱਚਿਆਂ ਨੂੰ ਲੈ ਕੇ ਆਉਂਦੇ ਹਾਂ ਅਸੀਂ ਸਕੂਲ ਲੈਵਲ ਦੇ ਹੁੰਦੇ ਆ ਜੀ ਜੀ ਜੀ ਮੈਮ ਜ਼ਰੂਰ ਜੀ ਜ਼ਰੂਰ ਮੈਮ ਜ਼ਰੂਰ ਦੱਸਦੇ ਰਹਾਂਗੇ ਕੋਈ ਗੱਲ ਨੀ ਮੈਮ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਓਕੇ ਜੀ